ਹਾਂ ਮੇਰੇ ਕੋਲ ਇੱਕ ਪੰਜਾਬੀ ਦੀ ਕਹਾਵਤ ਆ ਮੈਂ ਤੁਹਾਨੂੰ ਸਭ ਨੂੰ ਉਹ ਸੁਣਾਉਣਾ ਚਾਹੁੰਦੀ ਹਾਂ ਇਹ ਕਹਾਵਤ ਤਿੰਨ ਛੋਟੇ ਬੱਚੇ ਬੁੱਢੀ ਚਾਚੀ ਦੇ ਨਾਲ ਗਰਮੀਆਂ ਦੀ ਦੁਪਹਿਰ ਨੂੰ ਗੱਡੀ 'ਚ ਯਾਤਰਾ ਕਰ ਰਹੇ ਸਨ ਅਤੇ ਬੱਚਿਆਂ ਵਿੱਚ ਦੋ ਕੁੜੀਆਂ ਅਤੇ ਇੱਕ ਛੋਟਾ ਮੁੰਡਾ ਸੀ ਚਾਚੀ ਗੱਡੀ ਦੇ ਡੱਬੇ ਵਿੱਚ ਕੋਨੇ ਦੀ ਸੀਟ 'ਤੇ ਬੈਠੀ ਹੋਈ ਸੀ ਅਤੇ ਇੱਕ ਕੁਆਰਾ ਗੱਭਰੂ ਜਿਹੜਾ ਇਸ ਪਾਲਟੀ ਨਾਲ ਸੰਬੰਧ ਨਹੀਂ ਰੱਖਦਾ ਸੀ ਉਹ ਵੀ ਚਾਚੀ ਦੇ ਸਾਹਮਣੇ ਇਸ ਡੱਬੇ ਵਿੱਚ ਬੈਠਿਆ ਹੋਇਆ ਸੀ ਬੱਚੇ ਬਹੁਤ ਗੱਲਾਂ ਕਰਦੇ ਸਨ ਉਹ ਆਪਣੀ ਬੁੱਢੀ ਚਾਚੀ ਕੋਲੋਂ ਬਹੁਤ ਪ੍ਰਸ਼ਨ ਪੁੱਛਦੇ ਸਨ ਜਦੋਂ ਛੋਟੀ ਕੁੜੀ ਨੇ ਇੱਕ ਗਾਣੇ ਦੀ ਲਾਈਨ ਗਾਉਣੀ ਸ਼ੁਰੂ ਕਰ ਦਿੱਤੀ ਤਦ ਚਾਚੀ ਨੇ ਤਿੰਨਾਂ ਬੱਚਿਆਂ ਨੂੰ ਖਿੜਕੀ ਦੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਕਹਾਣੀ ਇੱਕ ਛੋਟੀ ਕੁੜੀ ਦੇ ਬਾਰੇ ਸੀ ਜਿਹੜੀ ਕਿ ਬਹੁਤ ਹੀ ਚੰਗੀ ਸੀ ਆਪੇ ਚੰਗਿਆਈ ਨਾਲ ਉਹਨੇ ਸਾਰਿਆਂ ਨਾਲ ਦੋਸਤੀ ਕਰ ਲਈ ਉਸਦੇ ਚੰਗੇ ਨੈਤਿਕ ਚਰਿੱਤਰ ਦੇ ਕਾਰਨ ਲੋਕਾਂ ਨੇ ਉਸਨੂੰ ਇੱਕ ਪਾਗਲ ਬੈਲ ਕੋਲੋਂ ਮਾਰੇ ਜਾਣ ਤੋਂ ਬਚਾ ਲਿਆ ਛੋਟੀ ਕੁੜੀ ਨੇ ਚਾਚੀ ਨੂੰ ਪੁੱਛਿਆ ਕਿ ਉਸਨੂੰ ਲੋਕ ਨਾ ਬਚਾਉਂਦੇ ਜੇਕਰ ਉਹ ਚੰਗੀ ਲੜਕੀ ਨਾ ਹੁੰਦੀ ਤਾਂ ਚਾਚੀ ਨੇ ਉੱਤਰ ਦਿੱਤਾ ਕਿ ਉਸ ਹਾਲਤ ਵਿੱਚ ਉਸਨੂੰ ਨਹੀਂ ਬਚਾਇਆ ਜਾ ਸਕਦਾ ਸੀ ਦੋ ਬੱਚਿਆਂ ਨੂੰ ਤਾਂ ਇਹ ਕਹਾਣੀ ਬੜੀ ਮੂਰਖਤਾ ਭਰੀ ਲੱਗੀ ਗੱਭਰੂ ਨੇ ਬੁੱਢੀ ਨੂੰ ਦੱਸਿਆ ਕਿ ਉਹ ਕੋਈ ਸਫਲ ਕਹਾਣੀ ਸੁਣਾਉਣ ਵਾਲੀ ਨਹੀਂ ਸੀ ਉਸਨੇ ਕਿਹਾ ਕਿ ਬੱਚਿਆਂ ਨੂੰ ਕਹਾਣੀ ਸੁਣਾਉਣਾ ਇੱਕ ਮੁਸ਼ਕਿਲ ਕੰਮ ਸੀ ਗੱਭਰੂ ਬੁੱਢੀ ਨਾਲ ਸਹਿਮਤ ਨਹੀਂ ਸੀ ਫਿਰ ਉਸਨੇ ਬੱਚਿਆਂ ਨੂੰ ਕਹਾਣੀ ਸੁਣਾਉਣ ਦੀ ਪੇਸ਼ਕਸ਼ ਕਰ ਦਿੱਤੀ ਕਹਾਣੀ ਇੱਕ ਛੋਟੀ ਲੜਕੀ ਬਿਰਥਾ ਦੇ ਬਾਰੇ ਸੀ ਉਹ ਬਹੁਤ ਚੰਗੀ ਸੀਗੀ ਉਹ ਆਪਣੇ ਕੱਪੜੇ ਸਾਫ਼ ਰੱਖਦੀ ਸੀ ਅਤੇ ਹਰੇਕ ਚੀਜ਼ ਨੂੰ ਅਨੁਸ਼ਾਸਿਤ ਢੰਗ ਦੇ ਨਾਲ ਕਰਦੀ ਸੀਗੀ ਉਹ ਜਿਹੜੇ ਆਪਣੇ ਚੰਗਿਆਈ ਦੇ ਕਾਰਨ ਤਿੰਨ ਮੈਡਲਾਂ ਨੂੰ ਜਿਹੜਾ ਆ ਪ੍ਰਾਪਤ ਕਰ ਚੁੱਕੀ ਸੀਗੀ ਅਤੇ ਉਹ ਇਹਨਾਂ ਮੈਡਲਾਂ ਨੂੰ ਆਪਣੇ ਕੱਪੜਿਆਂ 'ਤੇ ਲਗਾ ਕੇ ਰੱਖਦੀ ਸੀ ਇੱਕ ਮੈਡਲ ਆਗਿਆ ਕਾਰਤਾ ਦੇ ਲਈ ਇੱਕ ਸਮੇਂ ਦੀ ਪਾਬੰਦੀ ਦੇ ਲਈ ਅਤੇ ਇੱਕ ਚੰਗੇ ਵਰਤਾਓ ਦੇ ਲਈ ਸੀ ਜਦੋਂ ਉਹ ਚੱਲਦੀ ਸੀ ਤਾਂ ਇਹ ਮੈਡਲ ਇੱਕ ਦੂਸਰੇ ਦੇ ਨਾਲ ਟਕਰਾ ਜਾਂਦੇ ਸਨ ਉਸਦੀ ਅੱਛਾਈ ਦੇ ਸਾਰੇ ਗੱਲਾਂ ਕਰਦੇ ਸਨ ਅਤੇ ਦੇਸ਼ ਦੇ ਰਾਜਕੁਮਾਰ ਨੇ ਉਸ ਦੀ ਭਲਾਈ ਦੇ ਬਾਰੇ ਸੁਣਿਆ ਉਸਨੇ ਉਸਨੂੰ ਆਗਿਆ ਦਿੱਤੀ ਕਿ ਉਸਦੇ ਪਾਰਕ ਦੇ ਵਿੱਚ ਹਫ਼ਤੇ ਵਿੱਚ ਇੱਕ ਵਾਰ ਸੈਰ ਕਰ ਲਿਆ ਕਰੇ ਨਗਰ ਦੇ ਬਾਹਰ ਇਹ ਇੱਕ ਸੁੰਦਰ ਪਾਰਕ ਸੀ ਅਤੇ ਕਿਸੇ ਬੱਚੇ ਨੂੰ ਇਸ ਵਿੱਚ ਆਉਣ ਦੀ ਆਗਿਆ ਨਹੀਂ ਸੀ ਇਕੱਲੀ ਬਰਥਾ ਨੂੰ ਹੀ ਇਸ ਪਾਰਕ ਦੇ ਵਿੱਚ ਆਉਣ ਦੀ ਆਗਿਆ ਮਿਲੀ ਤੇ ਤਿੰਨ ਬੱਚਿਆਂ ਵਿੱਚੋਂ ਇੱਕ ਲੜਕਾ ਬੋਲਿਆ ਅਤੇ ਗੱਭਰੂ ਨੂੰ ਪੁੱਛਣ ਲੱਗਿਆ ਕਿ ਪਾਰਕ ਵਿੱਚ ਕੋਈ ਭੇਡ ਵੀ ਸੀ ਗੱਭਰੂ ਨੇ ਦੱਸਿਆ ਕਿ ਪਾਰਕ ਵਿੱਚ ਕੋਈ ਭੇਡ ਨਹੀਂ ਸੀ ਕਿਉਂਕਿ ਰਾਜਕੁਮਾਰ ਦੀ ਮਾਤਾ ਨੇ ਇੱਕ ਵਾਰ ਸੁਪਨਾ ਦੇਖਿਆ ਸੀ ਕਿ ਉਸਦਾ ਬੇਟਾ ਜਾਂ ਤਾਂ ਭੇਡ ਦੁਆਰਾ ਮਾਰਿਆ ਜਾਵੇਗਾ ਜਾਂ ਸਿਰ 'ਤੇ ਕਲੋਕ ਡਿੱਗਣ ਦੇ ਨਾਲ ਉਸ ਕਾਰਨ ਰਾਜ ਕੁਮਾਰ ਨੇ ਆਪਣੇ ਪਾਰਕ ਵਿੱਚ ਕੋਈ ਭੇਡ ਨਹੀਂ ਰੱਖੀ ਨਾ ਹੀ ਮਹਿਲ ਵਿੱਚ ਕਲੋਕ ਰੱਖਿਆ ਸੀ ਅਤੇ ਉਹ ਲੜਕਾ ਜਾਣਨਾ ਚਾਹੁੰਦਾ ਸੀ ਕਿ ਰਾਜਕੁਮਾਰ ਦੀ ਮੌਤ ਭੇਡ ਦੇ ਕਾਰਨ ਜਾਂ ਕਲੋਕ ਡਿੱਗਣ ਦੇ ਕਾਰਨ ਹੋਈ ਸੀ ਗੱਬਰੂ ਨੇ ਦੱਸਿਆ ਕੀ ਰਾਜਕੁਮਾਰ ਜ਼ਿੰਦਾ ਸੀ ਇਸ ਲਈ ਇਹ ਕਿਹਾ ਨਹੀਂ ਜਾ ਸਕਦਾ ਕਿ ਉਸ ਦਾ ਸੁਪਨਾ ਸੱਚ ਹੋਵੇਗਾ ਪਾਰਕ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸੂਰ ਸਨ ਪਾਰਕ ਵਿੱਚ ਫੁੱਲ ਨਹੀਂ ਸਨ ਪਾਰਕ ਵਿੱਚ ਹੋਰ ਵੀ ਸੁੰਦਰ ਚੀਜ਼ਾਂ ਸਨ ਉੱਥੇ ਕਈ ਛੱਪੜ ਸਨ ਜਿਹਨਾਂ 'ਚ ਸੁੰਦਰ ਮੱਛੀਆਂ ਸਨ ਸੁੰਦਰ ਤੋਤੇ ਜਿਹੜੇ ਬਹੁਤ ਚੰਗੀਆਂ ਗੱਲਾਂ ਬੋਲਦੇ ਸਨ ਪਾਰਕ ਵਿੱਚ ਦਰੱਖਤਾਂ ਦੇ ਉੱਪਰ ਬੈਠੇ ਰਹਿੰਦੇ ਸਨ ਅਤੇ ਜਿਹੜੇ ਪੰਛੀ ਆ ਉਹ ਧੁਨਾਂ ਗਾਉਂਦੇ ਸੀਗੇ ਬਰਥਾ ਪਾਰਕ ਵਿੱਚ ਟਹਿਲਦੀ ਸੀ ਅਤੇ ਖੂਬ ਮਜ਼ਾ ਲੈਂਦੀ ਸੀ ਉਸ ਸਮੇਂ ਇੱਕ ਚਿੱਕੜ ਰੰਗ ਦਾ ਬਗਿਆੜ ਪਾਰਕ ਵਿੱਚ ਆਇਆ ਉਸਨੇ ਬਰਥਾ ਨੂੰ ਦੇਖਿਆ ਬਰਥਾ ਨੇ ਵੀ ਉਸਨੂੰ ਆਪਣੇ ਵੱਲ ਚੋਰੀ ਚੋਰੀ ਆਉਂਦੇ ਹੋਏ ਦੇਖਿਆ ਉਹ ਡਰ ਗਈ ਉਸਨੇ ਇਹ ਇੱਛਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਕਿ ਉਸਨੂੰ ਪਾਰਕ ਵਿੱਚ ਆਉਣ ਦੀ ਆਗਿਆ ਨਾ ਮਿਲੀ ਹੁੰਦੀ ਉਹ ਬਗਿਆੜ ਤੋਂ ਬਚਣ ਦੇ ਲਈ ਇੱਕ ਝਾੜੀ ਵਿੱਚ ਛੁੱਪ ਗਈ ਉਸਨੇ ਡਰ ਨਾਲ ਕੰਬਣਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਉਹ ਕੰਬੀ ਤਾਂ ਮੈਡਲ ਇੱਕ ਦੂਸਰੇ ਦੇ ਨਾਲ ਟਕਰਾਏ ਬਗਿਆੜ ਨੇ ਟਕਰਾਉਣ ਦੀ ਆਵਾਜ਼ ਸੁਣ ਲਈ ਉਹ ਝਾੜੀ ਵਿੱਚ ਦੌੜ ਕੇ ਗਿਆ ਅਤੇ ਉੱਥੇ ਬਰਥਾ ਨੂੰ ਘਸੀੜਦਾ ਹੋਇਆ ਲੈ ਗਿਆ ਅਤੇ ਉਸਦੇ ਸਰੀਰ ਨੂੰ ਆਖਰੀ ਬੁਰਕੀ ਤੱਕ ਖਾ ਗਿਆ ਸਿਰਫ਼ ਉਸਦੇ ਜੁੱਤੇ ਕੱਪੜੇ ਅਤੇ ਅੱਛਾਈ ਦੇ ਲਈ ਮਿਲੇ ਹੋਏ ਤਿੰਨ ਮੈਡਲ ਬਚੇ ਇੱਕ ਲੜਕੀ ਨੇ ਟਿੱਪਣੀ ਕੀਤੀ ਕਿ ਕਹਾਣੀ ਦਾ ਆਰੰਭ ਤਾਂ ਬੁਰਾ ਸੀ ਲੇਕਿਨ ਇਸਦਾ ਅੰਤ ਬਹੁਤ ਸੁੰਦਰ ਸੀ ਇੱਕ ਲੜਕੀ ਨੇ ਕਿਹਾ ਕਿ ਉਸ ਦੁਆਰਾ ਸੁਣਾਈ ਗਈ ਇਹ ਬਹੁਤ ਹੀ ਸੁੰਦਰ ਕਹਾਣੀ ਸੀ ਲੜਕੇ ਨੇ ਕਿਹਾ ਇਹ ਤਾਂ ਕੇਵਲ ਸੁੰਦਰ ਕਹਾਣੀ ਸੀ ਬੱਚਿਆਂ ਦੁਆਰਾ ਕੀਤੀ ਗਈ ਟਿੱਪਣੀ ਨਾਲ ਚਾਚੀ ਸਹਿਮਤ ਨਹੀਂ ਸੀ ਉਹਨੇ ਕਿਹਾ ਕਿ ਬੱਚਿਆਂ ਨੂੰ ਸੁਣਾਉਣ ਦੇ ਲਈ ਇਹ ਇੱਕ ਅਣਉਚਿਤ ਕਹਾਣੀ ਹੈ ਇਸ ਕਹਾਣੀ ਵਿੱਚ ਸਾਵਧਾਨੀ ਨਾਲ ਕੀਤੀ ਗਈ ਪੜ੍ਹਾਈ ਦੇ ਅਸਰ ਨੂੰ ਹਾਨੀ ਪਹੁੰਚਾਈ ਗਈ ਸੀ ਗੱਭਰੂ ਡੱਬਾ ਛੱਡਣ ਵਾਲਾ ਹੀ ਸੀ ਉਸਨੇ ਕਿਹਾ ਕਿ ਉਸਨੇ ਬੱਚਿਆਂ ਨੂੰ ਦਸ ਮਿੰਟਾਂ ਦੇ ਲਈ ਘੱਟੋ ਘੱਟ ਚੁੱਪ ਕਰਵਾ ਕੇ ਰੱਖਿਆ ਸੀ ਬੁੱਢੀ ਚਾਚੀ ਤਾਂ ਇਸ ਤਰ੍ਹਾਂ ਨਹੀਂ ਕਰ ਸਕੀ ਸੀ ਗੱਭਰੂ ਟੈਂਪਲਕੋਮ ਦੇ ਸਟੇਸ਼ਨ 'ਤੇ ਚੱਲਣ ਲੱਗ ਪਿਆ ਉਸਨੇ ਕਿਹਾ ਬੁੱਢੀ ਇੱਕ ਨਾਖੁਸ਼ ਔਰਤ ਸੀ ਬੱਚੇ ਉਸਨੂੰ ਇਸ ਤਰ੍ਹਾਂ ਦੀ ਅਣਉਚਿਤ ਕਹਾਣੀ ਸੁਣਾਉਣ ਦੇ ਲਈ ਤੰਗ ਕਰਨਗੇ